ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਜਦੋਂ ਕੋਈ ਕੰਮ ਚੱਲ ਰਿਹਾ ਹੁੰਦਾ ਸਾਡਾ ਤਾਂ ਕਈ ਵਾਰ ਸਾਡੇ ਕੋਲੋਂ ਕਈ ਮੁਸ਼ਕਲਾਂ ਵੀ ਆਉਂਦੀਆਂ ਨੇ ਕਈ ਗਲਤੀਆਂ ਵੀ ਹੁੰਦੀਆਂ ਨੇ ਉਹਨਾਂ ਨੂੰ ਗਲਤੀਆਂ ਨੂੰ ਅਸੀਂ ਠੀਕ ਵੀ ਆਪ ਹੀ ਕਰਨਾ ਹੁੰਦਾ ਹੈ ਅਤੇ ਮੇਰਾ ਵੀ ਇਸ ਮੇਰਾ ਵੀ ਇੱਦਾਂ ਹੀ ਇੱਕ ਅਨੁਭਵ ਹੋਇਆ ਕਿ ਮੇਰਾ ਵੀ ਆਪਣੀ ਬਟੀਕ ਹੈ ਸਿਲਾਈ ਦਾ ਕੰਮ ਹੈ ਮੇਰਾ ਅਤੇ ਸਿਲਾਈ ਕਰਦੇ ਸਮੇਂ ਮੇਰੇ ਕੋਲੋਂ ਇੱਕ ਸੂਟ ਦੀ ਕਟਿੰਗ ਮੈਂ ਕਰ ਰਹੀ ਸੀ ਅਤੇ ਮੇਰੇ ਉਹ ਸੂਟ ਦੀ ਕਟਿੰਗ ਮੇਰੇ ਕੋਲੋਂ ਗਲਤ ਹੋ ਗਈ ਗਲਤ ਇੱਦਾਂ ਹੋਈ ਕਿ ਮੈਂ ਉਹ ਸੂਟ ਦੇ ਉੱਪਰ ਜਿਹੜੀ ਕਢਾਈ ਹੋਈ ਹੋਈ ਸੀ ਮੈਂ ਉਹ ਵੀ ਗਲਤੀ ਨਾਲ ਕਟਿੰਗ ਦੇ ਵਿੱਚ ਲੈ ਆਈ ਮੈਂ ਆਪਣੇ ਵੱਲੋਂ ਤਾਂ ਸੂਟ ਨੂੰ ਬਿਲਕੁਲ ਠੀਕ ਤਹਿ ਕੀਤਾ ਉਸ ਤਰ੍ਹਾਂ ਨਾਲ ਕੀਤਾ ਕਿ ਮੈਂ ਕਟਿੰਗ ਕਰਨੀ ਹੈ ਪਰ ਉਹਦੀ ਕਢਾਈ ਕੱਟੀ ਗਈ ਮੇਰੇ ਤੋਂ ਅਤੇ ਉਸ ਵੇਲੇ ਤਾਂ ਇੱਕ ਬਹੁਤ ਵੱਡੀ ਟੈਨਸ਼ਨ ਦਿਮਾਗ 'ਚ ਆ ਗਈ ਕਿ ਕਿਸੇ ਕਸਟਮਰ ਦਾ ਸੂਟ ਹੈ ਬੜਾ ਮਹਿੰਗਾ ਸੂਟ ਹੈ ਇਹ ਖਰਾਬ ਹੋ ਗਿਆ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਪਰ ਫਿਰ ਉਹਨੂੰ ਮੈਂ ਬਹੁਤ ਆਰਾਮ ਨਾਲ ਠੰਡੇ ਦਿਮਾਗ ਨਾਲ ਬੈਠ ਕੇ ਸੋਚਿਆ ਕਿ ਇਹਦਾ ਕੀ ਕੀਤਾ ਜਾ ਸਕਦਾ ਹੈ ਫਿਰ ਮੈਂ ਉਹਨੂੰ ਉਹਦੇ ਵਿੱਚ ਡਿਜ਼ਾਇਨਿੰਗ ਇਸ ਹਿਸਾਬ ਨਾਲ ਲਗਾਈ ਵਿੱਚ ਪਾਈਪਿੰਗ ਲਗਾਈ ਵਿੱਚ ਡਿਜ਼ਾਇਨਿੰਗ ਲਗਾਈ ਕਿ ਬਿਲਕੁਲ ਉਹਦੇ 'ਚ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਦੇਖਣ ਦੇ ਵਿੱਚ ਕਿ ਇਹਦੀ ਅਸੀਂ ਕਢਾਈ ਕੱਟੀ ਜਾ ਜਾ ਚੁੱਕੀ ਸੀ ਉਹਦੀ ਇਸ ਹਿਸਾਬ ਨਾਲ ਅਸੀਂ ਉਹਦੀ ਸਿਲਾਈ ਕੀਤੀ ਉਹਦੇ ਵਿੱਚ ਮੈਂ ਪਾਈਪਿੰਗ ਇਸ ਹਿਸਾਬ ਨਾਲ ਰੱਖੀ ਲੇਸਿਸ ਦੀ ਇਸ ਹਿਸਾਬ ਨਾਲ ਡਿਜਾਇਨਿੰਗ ਕੀਤੀ ਕਿ ਉਹ ਇੱਦਾਂ ਲੱਗ ਰਿਹਾ ਸੀ ਕਿ ਉਹ ਕਢਾਈ ਹੀ ਇਸ ਤਰ੍ਹਾਂ ਕਰਵਾਈ ਗਈ ਹੈ ਕਿ ਉਹਦੇ ਵਿੱਚ ਅਸੀਂ ਪਾਈਪਿੰਗ ਦਾ ਡਿਜ਼ਾਇਨ ਆਪ ਰੱਖ ਕੇ ਬਣਵਾਇਆ ਅਤੇ ਬੜਾ ਅੱਛਾ ਲੱਗਾ ਜਦੋਂ ਬਿਲਕੁਲ ਪੂਰਾ ਸੂਟ ਤਰ ਤਿਆਰ ਹੋ ਗਿਆ ਬਿਲਕੁਲ ਉਹਦੀ ਜਦੋਂ ਮੈਂ ਫਿਨਿਸ਼ਿੰਗ ਕੀਤੀ ਉਹਨੂੰ ਪ੍ਰੈਸ ਕੀਤਾ ਤਾਂ ਉਹ ਦੇਖਣ 'ਚ ਬਹੁਤ ਸੋਹਣਾ ਲੱਗਾ ਅਤੇ ਚਲੋ ਉਸ ਵੇਲੇ ਤਾਂ ਪਰਮਾਤਮਾ ਦਾ ਬਹੁਤ ਸ਼ੁਕਰ ਕੀਤਾ ਕਿ ਨੁਕਸਾਨ ਨਹੀਂ ਹੋਇਆ ਪਰ ਇਸ ਅਨੁਭਵ ਤੋਂ ਮੈਂ ਇਹ ਸਿੱਖਿਆ ਕਿ ਜਦੋਂ ਅਸੀਂ ਕੋਈ ਕੰਮ ਕਰ ਰਹੇ ਹੁੰਦੇ ਹਾਂ ਨਾ ਸਾਨੂੰ ਆਪਣਾ ਜਿਹੜਾ ਦਿਮਾਗ ਹੈ ਟੋਟਲ ਆਪਣਾ ਸੋਚਣ ਸ਼ਕਤੀ ਹੈ ਜਿਹੜੀ ਉਸ ਕੰਮ 'ਚ ਲਗਾਉਣੀ ਚਾਹੀਦੀ ਹੈ ਜਦੋਂ ਅਸੀਂ ਆਪਣੇ ਦਿਮਾਗ ਦੇ ਵਿੱਚ ਕੁਛ ਹੋਰ ਸੋਚ ਰਹੇ ਹੁੰਦੇ ਹਾਂ ਕੰਮ ਕੁਛ ਹੋਰ ਕਰ ਰਹੇ ਹੁੰਦੇ ਹਾਂ ਅਤੇ ਉਹਦੇ ਨਾਲ ਨੁਕਸਾਨ ਹੋਣਾ ਸਾਡਾ ਡਰ ਹੁੰਦਾ ਨੁਕਸਾਨ ਹੋਣ ਦਾ ਪਰ ਇਹ ਹੈ ਵੀ ਜਦੋਂ ਅਸੀਂ ਆਪਣਾ ਪੂਰਾ ਧਿਆਨ ਉਸ ਕੰਮ ਦੇ ਵਿੱਚ ਲਗਾ ਕੇ ਕਰਦੇ ਹਾਂ ਅਤੇ ਫੇਰ ਅਸੀਂ ਉਸ ਕੰਮ ਨੂੰ ਸਿਰੇ ਚੜ੍ਹਾ ਸਕਦੇ ਹਾਂ ਇਸ ਚੀਜ਼ ਤੋਂ ਮੈਂ ਇਹੀ ਸਿੱਖਿਆ ਕਿ ਜਦੋਂ ਵੀ ਅਸੀਂ ਕੁਛ ਇੱਦਾਂ ਦਾ ਕੰਮ ਬਹੁਤ ਮਤਲਬ ਇੰਨਾ ਮਹਿੰਗਾ ਕੰਮ ਕਰ ਰਹੇ ਹਾਂ ਅਤੇ ਫਿਰ ਅਸੀਂ ਆਪਣਾ ਧਿਆਨ ਦਿਲ ਦਿਮਾਗ ਟੋਟਲ ਹੀ ਅਸੀਂ ਇਸ ਕੰਮ ਦੇ ਵਿੱਚ ਲਗਾਈਏ ਤਾਂ ਫੇਰ ਹੀ ਅਸੀਂ ਇਸ ਕੰਮ ਨੂੰ ਸਿਰੇ ਚੜ੍ਹਾ ਸਕਦੇ ਹਾਂ